ਅਸੀਂ ਜ਼ਿਆਦਾਤਰ ਖਬਰਾਂ ਆਪਣੀ ਮਾਤ ਬੋਲੀ ਪੰਜਾਬੀ ਵਿੱਚ ਹੀ ਦੇਖਦੇ ਹਾਂ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਰਕੇ ਸਾਨੂੰ ਕਈ ਭਾਸ਼ਾਵਾਂ ਦੀ ਬਹੁਤ ਘੱਟ ਸਮਝ ਆਉਂਦੀ ਹੈ ਇਸ ਕਰਕੇ ਅਸੀਂ ਪੰਜਾਬੀ ਹੀ ਜ਼ਿਆਦਾ ਬੋਲਦੇ ਹਾਂ ਅਤੇ ਟੀ ਵੀ ਚੈਨਲ ਵੀ ਪੰਜਾਬੀ ਦੇ ਦੇਖਦੇ ਹਨ ਬਹੁਤ ਸਾਰੇ ਪੰਜਾਬੀ ਖਬਰਾਂ ਦੇ ਟੀ ਵੀ ਚੈਨਲ ਆਉਂਦੇ ਹਨ ਜਿਵੇਂ ਕਿ ਪੀ ਟੀ ਸੀ ਪੰਜਾਬੀ ਜੀ ਪੰਜਾਬੀ ਪੰਜਾਬੀ ਗੋਲਡ ਪੀ ਟੀ ਸੀ ਸਿਮਰਨ ਆਦਿ ਪੰਜਾਬੀ ਅਖਬਾਰਾਂ ਵੀ ਸਾਡੇ ਘਰ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ ਅਜੀਤ ਅਖਬਾਰ ਜਗਬਾਣੀ ਹਨ ਉਂਝ ਤਾਂ ਅਸੀਂ ਡਿਸ ਟੀ ਵੀ ਲਗਵਾਇਆ ਹੋਇਆ ਹੈ ਅਤੇ ਬਹੁਤ ਸਾਰੇ ਭਾਸ਼ਾਵਾਂ ਦੇ ਚੈਨਲ ਚੱਲਦੇ ਹਨ ਹਿੰਦੀ ਖਬਰਾਂ ਅਤੇ ਹਿੰਦੀ ਗਾਣਿਆਂ ਦੇ ਚੈਨਲ ਵੀ ਬਹੁਤ ਆਉਂਦੇ ਹਨ ਹੋਰ ਭਾਸ਼ਾਵਾਂ ਦੇ ਜਿਵੇਂ ਕਿ ਅੰਗਰੇਜ਼ੀ ਖਬਰਾਂ ਦੇ ਚੈਨਲ ਵੀ ਬਹੁਤ ਉਪਲਬਧ ਹਨ ਦੂਰਦਰਸ਼ਨ ਦੇ ਬਹੁਤ ਸਾਰੇ ਖੇਤਰੀ ਭਾਸ਼ਾਵਾਂ ਦੇ ਚੈਨਲ ਵੀ ਚੱਲਦੇ ਹਨ ਪਰ ਸਾਨੂੰ ਬਾਕੀ ਭਾਸ਼ਾਵਾਂ ਦੀ ਇੰਨੀ ਸਮਝ ਨਹੀਂ ਆਉਂਦੀ ਇਸ ਲਈ ਅਸੀਂ ਦਰਬਾਰ ਸਾਹਿਬ ਦਾ ਕੀਰਤਨ ਸੁਣਨ ਲਈ ਜਾਂ ਖਬਰਾਂ ਸੁਣਨ ਲਈ ਪੀ ਟੀ ਸੀ ਸਿਮਰਨ ਅਤੇ ਪੰਜਾਬੀ ਦੇ ਚੈਨਲ ਹੀ ਦੇਖਦੇ ਹਾਂ ਹੋਰ ਹੀ ਜ਼ਿਆਦਾ ਚੈਨਲਾਂ ਵਿੱਚ ਸਾਡਾ ਇਟਰੈਸਟ ਨਹੀਂ ਬਣਦਾ ਮਨੋਰੰਜਨ ਵਾਲੇ ਚੈਨਲ ਜਿਵੇਂ ਕਿ ਡਰਾਮਾ ਫਿਲਮਾਂ ਆਦਿ ਵੀ ਅਸੀਂ ਪੰਜਾਬੀ ਵਿੱਚ ਹੀ ਦੇਖਣਾ ਪਸੰਦ ਕਰਦੇ ਹਾਂ